ਸਤਿ ਸ਼੍ਰੀ ਅਕਾਲ ਸਰ ਹਾਂਜੀ ਸਰ ਹੋਰ ਕਿਵੇਂ ਹੋ ਅਤੇ ਘਰ ਪਰਿਵਾਰ ਕਿੱਦਾਂ ਜੀ ਹਾਂਜੀ ਠੀਕ ਠਾਕ ਆ ਅਤੇ ਮੈਂ ਇਹ ਗੱਲ ਕਹਿਣਾ ਚਾਹੁੰਦੀ ਸੀ ਵੀ ਕੋਵਿਡ ਦੇ ਦੌਰਾਨ ਜੋ ਬੱਚਿਆਂ ਦੀ ਪੜ੍ਹਾਈ ਦਾ ਨ ਨੁਕਸਾਨ ਹੋਇਆ ਹੈ ਬਹੁਤ ਹੀ ਲੋਸ ਹੋ ਗਿਆ ਹੈ ਇਸ ਕਰਕੇ ਆਪਾਂ ਬੱਚਿਆਂ ਦੀਆਂ ਜੋ ਬੋਰਡ ਵਾਲੇ ਨੇ ਉਹਨਾਂ ਦੀਆਂ ਐਕਸਟਰਾ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹਾਂ ਪ੍ਰਿੰਸੀਪਲ ਮੈਮ ਤੋਂ ਪੁੱਛ ਕੇ ਹਾਂਜੀ ਸਰ ਫਿਰ ਜੋ ਆਪਾਂ ਜੂਮ 'ਤੇ ਕਲਾਸਾਂ ਲਾਉਂਦੇ ਸੀ ਉਹਦੇ ਵਿੱਚ ਕੁਝ ਬੱਚੇ ਕਲਾਸਾਂ ਲਾਉਂਦੇ ਸੀ ਕੁਝ ਨਹੀਂ ਲਾਉਂਦੇ ਸੀ ਇਸ ਕਰਕੇ ਬਹੁਤ ਨੁਕਸਾਨ ਹੋ ਰਿਹਾ ਪੜ੍ਹਾਈ ਦਾ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਹਾਂਜੀ ਕਈ ਬੱਚੇ ਤਾਂ ਕਨੈਕਟ ਕਰਕੇ ਕੈਮਰਾ ਔਫ ਕਰਕੇ ਸੋ ਵੀ ਜਾਂਦੇ ਸੀ ਉਹਨਾਂ ਦਿਨਾਂ ਵਿੱਚ

ਹਾਂਜੀ ਹਾਂਜੀ ਕੋਈ ਨਾ ਸਰ ਆਪਾਂ ਗੱਲ ਕਰਦੇ ਹਾਂ ਸਰ ਨਾਲ ਵੀ ਮੀਟਿੰਗ ਕਰਵਾਉਂਦੇ ਹਾਂ ਇੱਕ ਵੀ ਉਹਦੇ ਵਿੱਚ ਅ ਕਹਿੰਦੇ ਹਾਂ ਵੀ ਅਸੀਂ ਐਕਸਟਰਾ ਕਲਾਸਾਂ ਲਗਾਇਆ ਕਰਾਂਗੇ ਅਤੇ ਜਿਹੜੇ ਬੋਰਡ ਵਾਲੇ ਬੱਚੇ ਨੇ ਜਿਵੇਂ ਕਿ ਦਸਵੀਂ ਬਾਰਵੀਂ ਵਾਲੇ ਉਹਨਾਂ ਦੇ ਐਕਸਟਰਾ ਕਲਾਸ ਦਾ ਚਾਂਸ ਸੁਬਾਹ ਜਾਂ ਸ਼ਾਮ ਨੂੰ ਲਗਾ ਲਿਆ ਕਰਾਂਗੇ ਜੀ ਹਾਂਜੀ ਕੋਈ ਨਾ ਸਰ ਉਹ ਵੀ ਦੇਖ ਦੇ ਹਾਂ ਜੀ ਬੱਚਿਆਂ ਨੂੰ ਤਿਆਰੀ ਕਰਵਾਉਦੇ ਹਾਂ ਜੀ ਹਾਂਜੀ ਉਹ ਵੀ ਸਰ ਕਰਵਾਉਂਦੇ ਹਾਂ ਤਿਆਰੀ ਜਵਾਕਾਂ ਦੀ

ਹਾਂਜੀ ਉਹ ਤਾਂ ਹੈ ਸਰ ਫਿਰ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਬਹੁਤ ਤਰਸ ਆ ਰਿਹਾ ਮੈਨੂੰ ਤਾਂ ਬੱਚਿਆਂ 'ਤੇ ਹਾਂਜੀ ਹਾਂ ਉਹ ਹੀ ਤਾਂ ਕਹਿ ਰਹੇ ਹਾਂ ਜੀ ਵੀ ਐਕਸਟਰਾ ਕਲਾਸਾਂ ਲਾਇਆ ਕਰਾਂਗੇ ਬੱਚਿਆਂ ਨੂੰ ਥੋੜ੍ਹੀ ਜਿਹੀ ਸਮਝ ਆਉਗੀ ਪੜ੍ਹਾਈ ਦੀ

ਹਾਂਜੀ ਹਾਂ ਸਰ ਕੋਈ ਨਾ ਆਪਾਂ ਮੈਡਮ ਨਾਲ ਗੱਲ ਕਰਦੇ ਹਾਂ ਹਾਂਜੀ ਠੀਕ ਹੈ ਕੋਈ ਨਾ ਸਰ ਗੱਲ ਕਰਦੇ ਹਾਂ ਆਪਾਂ